ਕੱਲ੍ਹ ਬਹੁਤ ਗਰਮੀ ਪੈ ਰਹੀ ਸੀ ਜਿਸ ਕਰਕੇ ਮੈਨੂੰ ਆਪਣੇ ਲਈ ਇੱਕ ਫੇਸ ਕਰੀਮ ਖਰੀਦਣ ਦੀ ਜ਼ਰੂਰਤ ਮਹਿਸੂਸ ਹੋਈ ਅਤੇ ਕਹਿੰਦੇ ਆ ਵੀ ਸਨ ਸੂਰਜ ਦੀ ਗਰਮੀ ਦੇ ਨਾਲ਼ ਵੀ ਤਾਪ ਦੇ ਨਾਲ਼ ਵੀ ਆਪਣਾ ਰੰਗ ਕਾਲਾ ਹੋ ਜਾਂਦਾ ਹੈ ਇਸ ਕਰਕੇ ਮੈਂ ਇੱਕ ਫੇਸ ਕਰੀਮ ਖਰੀਦ ਕੇ ਲਿਆਈ ਪਰ ਜਦੋਂ ਮੈਂ ਉਹ ਫੇਸ ਕਰੀਮ ਆਪਣੇ ਮੂੰਹ 'ਤੇ ਲਗਾਈ ਤਾਂ ਮੈਨੂੰ ਆਪਣੀ ਰੰਗਤ ਕੁਝ ਕਾਲੀ ਮਹਿਸੂਸ ਹੋਈ ਪਰ ਮੈਂ ਪਹਿਲੇ ਦਿਨ ਇਗਨੋਰ ਕਰਤਾ ਵੀ ਚਲੋ ਪਹਿਲੀ ਵਾਰ ਲਗਾਈ ਹੈ ਹੌਲ਼ੀ ਹੌਲ਼ੀ ਅਸਰ ਹੋਵੇਗਾ ਪਰ ਜਦੋਂ ਮੈਂ ਤਿੰਨ ਚਾਰ ਦਿਨ ਇਹਨੂੰ ਲਗਾਤਾਰ ਵਰਤਿਆ ਤਾਂ ਮੈਂ ਮਹਿਸੂਸ ਕੀਤਾ ਕਿ ਮੇਰੀ ਮੂੰਹ 'ਤੇ ਛਾਈਆਂ ਪੈ ਗਈਆਂ ਅਤੇ ਬਾਰੀਕ ਬਾਰੀਕ ਦਾਣੇ ਨਿਕਲ ਆਏ ਜਿਸ ਕਾਰਨ ਮੇਰਾ ਦਿਲ ਬਹੁਤ ਟੁੱਟ ਗਿਆ ਤੇ ਬੜਾ ਬੁਰਾ ਮਹਿਸੂਸ ਹੋਇਆ